ਇੰਟਰਨੈਟ ਤਾਂ ਅੱਜ ਕੱਲ ਹਰੇਕ ਦੀ ਲੋੜ ਹੀ ਬਣ ਗਿਆ ਹੈ ਖਾਸ ਕਰ ਮੋਬਾਈਲ 'ਤੇ ਇੰਟਰਨੈਟ ਆਉਣ ਤੋਂ ਬਾਅਦ ਤਾਂ ਇੰਟਰਨੈਟ ਦੀ ਵਰਤੋਂ ਬਹੁਤ ਜ਼ਿਆਦਾ ਵੱਧ ਗਈ ਹੈ ਕਿਉਂਕਿ ਅੱਜ ਕੱਲ ਤਾਂ ਹਰੇਕ ਬੰਦੇ ਕੋਲ ਕੋਈ ਨਾ ਕੋਈ ਮੋਬਾਈਲ ਤਾਂ ਹੁੰਦਾ ਹੀ ਹੈ ਰਿਟਾਇਰਡ ਅਤੇ ਬਜ਼ੁਰਗ ਵੀ ਅੱਜਕੱਲ ਇਸ ਦਾ ਪ੍ਰਯੋਗ ਕਰਦੇ ਹਨ ਜੋ ਕਿ ਆਮ ਕਰਕੇ ਖਬਰਾਂ ਸੁਣਨ ਖੇਡਾਂ ਜਾਂ ਹੋਰ ਮਨੋਰੰਜਨ ਦੇ ਸਾਧਨਾਂ ਲਈ ਇਸ ਇਸਦਾ ਪ੍ਰਯੋਗ ਕਰਦੇ ਹਨ ਅੱਜ ਕੱਲ ਤਾਂ ਕੋਈ ਸਮਾਨ ਮੰਗਵਾਉਣਾ ਹੋਵੇ ਜਾਂ ਕੋਈ ਕੱਪੜੇ ਖਰੀਦਣੇ ਹੋਣ ਉਹ ਵੀ ਇੰਟਰਨੈਟ ਤੋਂ ਹੋ ਜਾਂਦਾ ਭਾਵੇਂ ਕੋਈ ਘਰ ਦਾ ਜਾਂ ਰਸੋਈ ਦਾ ਖਾਣ ਪੀਣ ਦਾ ਜਾਂ ਕਰਿਆਨੇ ਦਾ ਕੋਈ ਸਮਾਨ ਮੰਗਾਉਣਾ ਹੋਏ ਉਹ ਸਾਰਾ ਹੀ ਇੰਟਰਨੈਟ ਦੀ ਵਰਤੋਂ ਕਰਕੇ ਅਸੀਂ ਮੰਗਵਾ ਸਕਦੇ ਹਾਂ ਅਤੇ ਇਸਦਾ ਭੁਗਤਾਨ ਵੀ ਗੂਗਲ ਪੇ ਪੇਟੀਐਮ ਜਾਂ ਹੋਰ ਕੋਈ ਯੂ ਪੀ ਆਈ ਦੁਆਰਾ ਸੌਖਾ ਹੀ ਹੋ ਜਾਂਦਾ ਹੈ ਅਤੇ ਭਾਵੇਂ ਕੋਈ ਰਿਚਾਰਜ ਕਰਨਾ ਹੋਏ ਰਿਟਾਇਰਡ ਜਾਂ ਬਜ਼ੁਰਗਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਸੋਖਾ ਹੀ ਇੰਟਰਨੈਟ ਤੋਂ ਹੋ ਜਾਂਦਾ ਹੈ ਬਸ ਇੱਕ ਵਾਰੀ ਸਿੱਖਣ ਦੀ ਲੋੜ ਪੈਂਦੀ ਹੈ ਜੋ ਕੀ ਕੋਈ ਔਖਾ ਕੰਮ ਨਹੀਂ ਹੈ ਇਸ ਲਈ ਬਜ਼ੁਰਗ ਇਸਦਾ ਟੈਕਨੋਲਜੀ ਦਾ ਬਹੁਤ ਪ੍ਰਯੋਗ ਕਰਕੇ ਬਹੁਤ ਇਸ ਤੋਂ ਫਾਇਦਾ ਲੈ ਰਹੇ ਹਨ